ਹੈਲੋ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਜੀ ਹਾਂਜੀ ਹਾਂਜੀ ਜਸਵਿੰਦਰ ਥੈਂਕ ਯੂ ਤੁਸੀਂ ਕੋਲ ਕੀਤੀ ਅਸੀਂ ਇਸੇ ਕੰਮ ਲਈ ਇੱਥੇ ਹੈਗੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਜਸਵਿੰਦਰ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਕਿ ਤੁਸੀਂ ਕੰਪਿਊਟਰ ਸਾਇੰਸ ਦੇ ਸਟੂਡੈਂਟ ਹੋ ਤਾਂ ਕੰਪਿਊਟਰ ਸਾਇੰਸ ਨਾਲ਼ ਸੰਬੰਧਿਤ ਇੱਥੇ ਆਪਣੇ ਮੇਨਲੀ ਆਈ ਟੀ ਅਤੇ ਸੋਫਟਵੇਅਰ ਫੀਲਡ ਨਾਲ਼ ਸੰਬੰਧਿਤ ਬਹੁਤ ਸਾਰੀਆਂ ਕੰਪਨੀਆਂ ਆਪਣੇ ਯੂਨੀਵਰਸਿਟੀ ਦੇ ਵਿੱਚ ਹਰੇਕ ਸਾਲ ਆਉਂਦੀਆਂ ਨੇ ਜਿੱਦਾਂ ਕਿ ਇਹ ਆਪਣੇ ਸੱਤਵੇਂ ਸਮੈਸਟਰ ਦੀ ਸਟਾਰਟਿੰਗ ਦੇ ਵਿੱਚ ਹੀ ਕੰਪਨੀਆਂ ਇੱਥੇ ਆਉਣ ਲੱਗ ਪੈਂਦੀਆਂ ਨੇ ਅਤੇ ਬਹੁਤ ਸਾਰੇ ਬੱਚਿਆਂ ਨੂੰ ਲੈ ਕੇ ਜਾਂਦੀਆਂ ਨੇ ਮੇਨਲੀ ਆਪਣੇ ਜਿਹੜਾ ਆ ਯੂਨੀਵਰਸਿਟੀ ਦੇ ਵਿੱਚ ਸਿਸਟਮ ਚੱਲਦਾ ਉਹਦੇ ਵਿੱਚ ਆਪਾਂ ਵਿਦਿਆਰਥੀਆਂ ਨੂੰ ਤਿੰਨ ਤਰ੍ਹਾਂ ਦੀਆਂ ਕੰਪਨੀਆਂ ਦੇ ਸਿਸਟਮ ਦੇ ਵਿੱਚ ਵੰਡਿਆ ਹੋਇਆ ਪਹਿਲਾਂ ਆਪਾਂ ਪੰਜ ਲੱਖ ਤੱਕ ਵਾਲੀਆਂ ਕੰਪਨੀਆਂ ਫਿਰ ਪੰਜ ਤੋਂ ਦਸ ਲੱਖ ਤੱਕ ਵਾਲੀਆਂ ਫਿਰ ਦਸ ਲੱਖ ਤੋਂ ਉੱਪਰ ਵਾਲੀਆਂ ਅਤੇ ਆਪਣੇ ਇੱਥੇ ਅਗਰ ਪਲੇਸਮੈਂਟ ਦੀ ਗੱਲ ਕਰੀਏ ਤਾਂ ਮੁੱਖ ਤੌਰ 'ਤੇ ਟੀ ਸੀ ਐੱਸ ਬਹੁਤ ਵੱਡੀ ਕੰਪਨੀ ਆ ਟਾਟਾ ਕੰਸਨਟਰੇਂਸੀ ਸਰਵਸਿਸ ਬਹੁਤ ਬੱਚੇ ਲੈ ਕੇ ਜਾਂਦੀ ਹੈ ਅਤੇ ਪੈਕੇਜ ਵੀ ਲਗਭਗ ਉਹ ਸਾਢੇ ਚਾਰ ਪੰਜ ਲੱਖ ਦਾ ਦਿੰਦੀ ਆ ਪਰ ਇਸ ਤੋਂ ਉੱਪਰ ਵਾਲੇ ਪੈਕੇਜ ਵਾਲੀਆਂ ਵੀ ਬਹੁਤ ਕੰਪਨੀਆਂ ਆਉਂਦੀਆਂ ਨੇ ਅਤੇ ਬਾਕੀ ਜਸਵਿੰਦਰ ਕੋਈ ਗੱਲ ਨਹੀਂ ਹੋਰ ਜੇ ਕੋਈ ਜ਼ਿਆਦਾ ਜਾਣਕਾਰੀ ਤੁਸੀਂ ਲੈਣੀ ਹੈ ਨਾ ਤੁਸੀਂ ਆਪਣੇ ਯੂਨੀਵਰਸਿਟੀ ਦੇ ਪਲੇਸਮੈਂਟ ਔਫ਼ਿਸ ਦੇ ਵਿੱਚ ਆ ਜਿਓ ਆਪਾਂ ਮਿਲ ਕੇ ਬੈਠ ਕੇ ਗੱਲ ਕਰਾਂਗੇ ਠੀਕ ਹੈ ਜੀ ਚੰਗਾ ਜੀ ਸਤਿ ਸ਼੍ਰੀ ਅਕਾਲ